ਪੰਜਾਬੀ ਭਾਸ਼ਾ ਸਾਡੇ ਪੰਜਾਬ ਦੀ ਮਾਤ ਭਾਸ਼ਾ ਹੈ ਇ ਇਸ ਵਿੱਚ ਕਈ ਉਪਭਾਸ਼ਾ ਵੀ ਹਨ ਜਿਵੇਂ ਕਿ ਅੰਬਰਸਰ ਹੋਰ ਭਾਸ਼ਾ ਅਤੇ ਗੁਰਦਾਸਪੁਰ ਜ਼ਿਲ੍ਹੇ ਦੀ ਹੋਰ ਭਾਸ਼ਾ ਅਤੇ ਬਠਿੰਡੇ ਦੀ ਹੋਰ ਭਾਸ਼ਾ ਅਤੇ ਰੋਪੜ ਦੀ ਹੋਰ ਭਾਸ਼ਾ ਉਪ ਭਾਸ਼ਾਵਾਂ ਦਾ ਦੀ ਵਰਤੋਂ ਕੀਤੀ ਜਾਂਦੀ ਹੈ ਵੱਖ ਵੱਖ ਜ਼ਿਲ੍ਹਿਆਂ ਵਿੱਚ ਪਰ ਪੰਜਾਬੀ ਸਾਡੀ ਮੇਨ ਆ ਲਿਖਤੀ ਜਿਹੜੀ ਹੈ ਉਹ ਇੱਕ ਆ